ਹੈਲੋ ਹਾਂਜੀ ਹਾਂਜੀ ਹਾਂਜੀ ਬੋਲ ਰਹੀ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਤੁਹਾਡੀ ਕੀ ਮਦਦ ਕਰ ਸਕਦੀ ਹਾਂ ਫਿਰ ਹਾਂਜੀ ਹਾਂਜੀ ਹਾਂਜੀ ਜ਼ਰੂਰ ਮੈਂ ਤੁਹਾਨੂੰ ਦੱਸ ਸਕਦੀ ਹਾਂ ਦੇਖੋ ਪੰਜਾਬ 'ਚ ਸਭ ਤੋਂ ਫੇਮਸ ਹੁਣ ਸਰਦੀਆਂ ਦਾ ਮੌਕਾ ਅਤੇ ਸਰਦੀਆਂ ਵਿੱਚ ਜ਼ਿਆਦਾ ਪੰਜਾਬ ਵਿੱਚ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਚੱਲਦੀ ਹੈ ਜ਼ਿਆਦਾਤਰ ਹੁਣ ਇਹ ਹੀ ਸੀਜ਼ਨ ਚੱਲ ਰਿਹਾ ਅਤੇ ਬਾਕੀ ਪੰਜਾਬ 'ਚ ਜਿਹੜੇ ਫੂਡ ਨੇ ਜਿਵੇਂ ਕਿ ਛੋਲੇ ਭਟੂਰੇ ਹੋ ਗਏ ਅੰਮ੍ਰਿਤਸਰੀ ਨਾਨ ਹੋ ਗਏ ਇਹ ਚੀਜ਼ਾਂ ਹਾਂਜੀ ਹੋਰ ਕੋਈ ਹੈਲਪ ਇਹਦੀਆਂ ਸ਼ੌਪਸ ਉੱਥੇ ਪਟਿਆਲੇ ਜਿਵੇਂ ਮੈਂ ਪਟਿਆਲੇ 'ਚ ਰਹਿੰਦੀ ਹਾਂ ਅਤੇ ਪਟਿਆਲੇ 'ਚ ਅੰਮ੍ਰਿਤਸਰੀ ਨਾਨ ਸ਼ੌਪ ਹੈ ਅਤੇ ਉੱਥੇ ਅੰਮ੍ਰਿਤਸਰੀ ਨਾਨ ਮਿਲਦਾ ਹੈ ਅਤੇ ਬਾਕੀ ਆਗਿਆ ਸਿੰਘ ਦਾ ਢਾਬਾ ਉੱਥੇ ਕਿਸੇ ਵੀ ਟਾਈਪ ਦੀ ਆਪਾਂ ਸਬਜ਼ੀ ਖਾ ਸਕਦੇ ਹਾਂ ਅਤੇ ਵਧੀਆ ਉਹਨਾਂ ਦਾ ਟੇਸਟ ਹੁੰਦਾ ਹੈ ਤੁਸੀਂ ਉੱਥੇ ਬਲੋਗ ਕਰ ਸਕਦੇ ਹੋ ਹਾਂਜੀ ਠੀਕ ਹੈ ਓਕੇ ਥੈਂਕ ਯੂ